ਮੈਂ ਵੈਸੇ ਤਾਂ ਗਾਇਕ ਨਹੀਂ ਪਰ ਜੇ ਗੱਲ ਹੋਵੇ ਪਹਿਲੀ ਵਾਰ ਗਾਇਕੀ 'ਚ ਰੁਚੀ ਪੈਦਾ ਹੋਣ ਦੀ ਤਾਂ ਇਹ ਹਮੇਸ਼ਾ ਅੰਦਰਲੀ ਪ੍ਰੇਰਨਾ ਜਾਂ ਕਿਸੇ ਖ਼ਾਸ ਯਾਦ ਦੇ ਕਾਰਨ ਹੁੰਦੀ ਹੈ

ਜਦੋਂ ਕਿਸੇ ਨੂੰ ਅਸੀਂ ਗਾਇਆ ਤਾਂ ਲੋਕਾਂ ਨੇ ਸ਼ਲਾਘਾ ਦਿੱਤੀ ਤਾਂ ਆਤਮ ਵਿਸ਼ਵਾਸ ਵੱਧਦਾ ਹੈ ਜੇ ਕੋਈ ਪਸੰਦੀਦਾ ਗਾਇਕ ਹੋਵੇ ਤਾਂ ਉਸ ਦੇ ਗੀਤ ਸੁਣ ਕੇ ਉਹਦੇ ਵਰਗਾ ਬਣਨ ਦੀ ਇੱਛਾ ਹੁੰਦੀ ਹੈ ਸਕੂਲਾਂ ਜਾਂ ਕਿਸੇ ਸਮਾਗਮ ਵਿੱਚ ਪਹਿਲੀ ਵਾਰ ਗਾਉਣ ਦਾ ਮੌਕਾ ਮਿਲੇ ਤਾਂ ਉਹ ਰੁਚੀ ਹੋਰ ਵੱਧ ਜਾਂਦੀ ਹੈ ਜਦੋਂ ਸਭ ਨੇ ਮੈਂ ਪਹਿਲੀ ਵਾਰ ਸਭ ਤੋਂ ਪਹਿਲਾਂ ਮੈਨੂੰ ਗਾਉਣ ਵਿੱਚ ਖਿੱਚਿਆ ਜਦੋਂ ਕਿ ਮੈਨੂੰ ਮੇਰੇ ਦੋਸਤਾਂ ਨੇ ਬਹੁਤ ਹੌਸਲਾ ਦਿੱਤਾ ਜਦੋਂ ਮੈਂ ਪਹਿਲੀ ਵਾਰ ਸਕੂਲ ਦੇ ਸਮਾਗਮ ਵਿੱਚ ਗਾਇਆ ਉਦੋਂ ਲੋਕਾਂ ਨੇ ਬਹੁਤ ਮੈਨੂੰ ਕਿਹਾ ਕਿ ਤੇਰੀ ਅਵਾਜ਼ ਬਹੁਤ ਵਧੀਆ ਹੈ ਤੂੰ ਬਹੁਤ ਵਧੀਆ ਗਾਉਂਦਾ ਹਾਂ ਇਸ ਕਰਕੇ ਮੇਰੀ ਗਾਉਣ ਵਿੱਚ ਬਹੁਤ ਹੀ ਜ਼ਿਆਦਾ ਰੁਚੀ ਪੈ ਗਈ ਧੰਨਵਾਦ ਜੀ